ਆਹ ਐਤਕੀ ਜਦੋਂ ਅਸੀਂ ਅੰਮ੍ਰਿਤਸਰ ਗਏ ਉੱਥੇ ਅਸੀਂ ਟੈਕਸੀ ਬੁੱਕ ਕੀਤੀ ਸੀ ਇੱਕ ਜਾਣੀ ਕਿ ਸਾਨੂੰ ਐਂ ਤਾਂ ਵੀ ਐਤਕੀ ਕੋਈ ਨਵੀਂ ਜਗ੍ਹਾ ਲੱਭੀਏ ਦੇਖੀਏ ਅਤੇ ਅਸੀਂ ਟੈਕਸੀ ਵਾਲੇ ਨਾਲ ਗੱਲਬਾਤ ਕੀਤੀ ਉਹਨੂੰ ਦੱਸਿਆ ਵੀ ਬਾਈ ਸਾਨੂੰ ਇੱਦਾਂ ਇੱਦਾਂ ਕਰਕੇ ਵੀ ਨਵੀਆਂ ਜਗ੍ਹਾਵਾਂ ਘੁੰਮਾਈ ਸਾਨੂੰ ਵੀ ਬੋਰ ਨਹੀਂ ਹੋਣੇ ਚਾਹੀਦੇ ਅਸੀਂ ਪਰ ਬਾਈ ਬੰਦੇ ਨੇ ਪੂਰਾ ਮੈਂ ਕਹਿੰਦਾ ਰੰਗ ਬੰਨਤੇ ਆ ਇੱਕ ਤਾਂ ਬੰਦੇ ਦਾ ਵਿਵਹਾਰ ਇੰਨਾਂ ਵਧੀਆ ਯਾਰ ਵੀ ਐਂ ਲੱਗੇ ਵੀ ਜਿਕਣ ਵੀ ਅਸੀਂ ਇਹ ਸਾਡੇ ਨਾਲੇ ਆਇਆ ਵਾ ਅਸੀਂ ਇਕੱਠੇ ਹੀ ਆਏ ਵੇ ਘੁੰਮਣ ਲੱਗੇ ਨਾ ਵੀ ਅਸੀਂ ਟੈਕਸੀ ਬੁੱਕ ਕਰੀ ਵੀ ਆ ਇਹੋ ਜਿਹਾ ਤਾਂ ਬੰਦਾ ਤਾ ਕਲੋਲੀ ਔਰ ਸਿਰਾ ਕਰਾ ਕੇ ਰੱਖਿਆ ਉਹਨੇ ਸਾਨੂੰ ਪਤਾ ਨਹੀਂ ਲੱਗਿਆ ਕਦੋਂ ਸਾਡਾ ਚਾਰ ਦਿਨ ਦਾ ਟਰਿੱਪ ਤਾ ਜਿਹੜਾ ਮੁੱਕ ਗਿਆ ਇਹੋ ਜਿਹਾ ਬੰਦਾ ਘੈਂਟ ਟੱਕਰਿਆ ਬ ਮੁੜ ਕੇ ਇਹੋ ਜਿਹੀ ਉਹਦੇ ਨਾਲ ਵੀ ਨੇੜਤਾ ਵਧੀ ਹੈ ਜਾਂ ਦੂਈ ਵਾਰ ਵੀ ਗਏ ਜਦ ਵੀ ਅਸੀਂ ਉਹਨੂੰ ਕਰਿਆ ਔਰ ਦੂਈ ਵਾਰ ਪਤੰਦਰ ਨੇ ਪੈਸੇ ਵੀ ਨਹੀਂ ਲਏ ਕਹਿੰਦਾ ਬ ਤੁਹਾਡੇ ਨਾਲੇ ਘੁੰਮਣਾ ਸਵਾਦ ਏ ਬਹੁਤ ਆਉਂਦਾ ਇਹੋ ਜਿਹਾ ਬੰਦਾ ਤਾ ਜਾਣੀ ਕਿ ਬੜਾ ਵਧੀਆ ਬੰਦਾ ਨਿਕਲਿਆ ਯਾਰ ਉਹ ਮਿਲਿਆ ਸਾਨੂੰ ਡਰਾਈਵਰ ਦੇ ਤੌਰ 'ਤੇ ਤਾ ਪਰ ਅੱਜ ਉਹ ਸਾਡਾ ਮਿੱਤਰ ਬਣ ਗਿਆ